ਪੰਜਾਬ ਦੇ ਵਿੱਚ ਕਈ ਧਰਮ ਪ੍ਰਮੁੱਖ ਨੇ ਜਿਵੇਂ ਕਿ ਹਿੰਦੂ ਮੁਸਲਮਨ ਸਿੱਖ ਈਸਾਈ ਲੇਕਿਨ ਚਾਰੋਂ ਹਨ ਇਹ ਆਪਣੇ ਭਾਈ ਭਾਈ ਇਹਨਾਂ ਦੇ ਵਿੱਚ ਧਰਮ ਦੇ ਅਧਾਰ 'ਤੇ ਕੋਈ ਜਾਤ ਵੰਡੀਆਂ ਨਹੀਂ ਪਈਆਂ ਨਾ ਹੀ ਇਹਨਾਂ ਨੂੰ ਪਾਉਣ ਦੀ ਜ਼ਰੂਰਤ ਹੈ ਕੁਝ ਕੁ ਸਾਡੇ ਜੋ ਧਰਮ ਦੇ ਆਗੂ ਨੇ ਉਹ ਹੀ ਇੱਕ ਦੂਜੇ ਨੂੰ ਧਰਮਾਂ ਦੇ ਵਿਰੁੱਧ ਭੜਕਾ ਰਹੇ ਹਨ ਕੁਝ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਜੀ ਸਿਰਫ ਰਾਮ ਤੀਰਥ 'ਤੇ ਜਾਣਾ ਹੈ ਕੁਝ ਲੋਕ ਕਹਿੰਦੇ ਨੇ ਜੀ ਸਾਡੇ ਲਈ ਤਾਂ ਮੱਕਾ ਮਦੀਨਾ ਹੀ ਸਾਰਾ ਕੁਝ ਹੈ ਕੁਝ ਕਹਿੰਦੇ ਨੇ ਅਸੀਂ ਤਾਂ ਜੀ ਇਕੱਲਾ ਗੋਲਡਨ ਟੈਂਪਲ ਹੀ ਜਾਣਾ ਹੈ ਅਤੇ ਕੁਝ ਕੁ ਕਹਿੰਦੇ ਹਨ ਕਿ ਸਾਡੇ ਕਿ ਲੇ ਬਾਈਬਲ ਗੀਤਾ ਪੁਰਾਨ ਅਤੇ ਕੁਝ ਇਹ ਸਾਰਾ ਕੁਝ ਬਰਾਬਰ ਹੀ ਹੈ ਇਸ ਲਈ ਮਨੁੱਖ ਨੂੰ ਇਹਨਾਂ ਧਰਮਾਂ ਅਤੇ ਜਾਤਾਂ ਤੋਂ ਉੱਪਰ ਉੱਠ ਕੇ ਸਿਰਫ ਇਕ ਮਾਨਵਤਾ ਦਾ ਜੋ ਧਰਮ ਹੈ ਉਸਨੂੰ ਅਪਣਾਉਣਾ ਚਾਹੀਦਾ ਹੈ ਦਿਸ ਕਿਉਂਕਿ ਜਿਹੜਾ ਜੋ ਸਾਡਾ ਭਾਰਤ ਹੈ ਇਸੇ ਵਿੱਚ ਜੋ ਸਾਡਾ ਸੰਵਿਧਾਨ ਹੈ ਉਹ ਧਰਮ ਨਿਰਪੱਖ ਧਰਮ ਨਿਰਪੱਖ ਹੈ ਭਾਵ ਧਰਮ ਨਿਰਪੱਖ ਤੋਂ ਭਾਵ ਕੀ ਹੈ ਕਿ ਰਾਜ ਦਾ ਆਪਣਾ ਕੋਈ ਧਰਮ ਨਹੀਂ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਧਰਮ ਮੰਨਣ ਦੀ ਖੁੱਲ੍ਹ ਹੈ ਉਹ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਕਿਸੇ ਵੀ ਧਰਮ ਨੂੰ ਉਹ ਛੱਡ ਸਕਦਾ ਹੈ ਲੇਕਿਨ ਸਰਕਾਰ ਦੀ ਨਜ਼ਰ ਦੇ ਵਿੱਚ ਜੋ ਸੰਵਿਧਾਨ ਦੀ ਨਜ਼ਰ ਦੇ ਵਿੱਚ ਜੋ ਸਾਰੇ ਹੀ ਜੋ ਧਰਮ ਨੇ ਉਹ ਇੱਕ ਬਰਾਬਰ ਹਨ